ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਤੁਸੀਂ ਸੁਖਦੀਪ ਸਿੰਘ ਜੀ ਬੋਲ ਰਹੇ ਜੀ ਸਰ ਮੈਂ ਤੁਹਾਡਾ ਨੰਬਰ ਆਪਣੀ ਇੱਕ ਫਰੈਂਡ ਕੋਲੋਂ ਲਿਤਾ ਸੀ ਹਰਦੀਪ ਤੁਸੀਂ ਪਿਛਲੇ ਦਿਨੀਂ ਉਹਨਾਂ ਦੇ ਘਰ ਕੰਮ ਕੀਤਾ ਸੀ ਇੰਟੀਰੀਅਰ ਦਾ ਬੈਡ ਵਗੈਰਾ ਬਣਾ ਕੇ ਦਿੱਤੇ ਸੀ ਜੀ ਮੈਂ ਉਹਨਾਂ ਦੇ ਘਰ ਕੱਲ੍ਹ ਵਿਜਿਟ ਕੀਤੀ ਸੀ ਅਤੇ ਉਹਨਾਂ ਨੇ ਮੈਨੂੰ ਨੰਬਰ ਦਿੱਤਾ ਤੁਹਾਡਾ ਬਣਿਆ ਫਰਨੀਚਰ ਜਿਹੜਾ ਮੈਨੂੰ ਬਹੁਤ ਪਸੰਦ ਆਇਆ ਸਰ ਮੈਂ ਵੀ ਹਾਂਜੀ ਹਾਂਜੀ ਮੈਂ ਵੀ ਉਸੇ ਤਰ੍ਹਾਂ ਦਾ ਕੰਮ ਥੋੜ੍ਹਾ ਆਪਣੇ ਘਰ ਕਰਵਾਉਣਾ ਚਾਹੁੰਦੀ ਸੀ ਮੈਂ ਇੱਕ ਬੈਡ ਬਣਵਾਉਣਾ ਸੀ ਬੇਟੇ ਦੇ ਲਈ ਅਤੇ ਮੈਨੂੰ ਪਲੀਜ਼ ਤੁਸੀਂ ਗਾਈਡ ਕਰੋ ਕਿ ਮੇਰੇ ਕਮਰਾ ਦਸ ਬਾਏ ਦਸ ਦਾ ਹੈ ਜੀ ਅਤੇ ਮੈਂ ਚਾਹੁੰਦੀ ਆ ਕਿ ਬੈਡ ਬਾਕਸ ਬੈਡ ਹੋ ਜੇ ਬਟ ਸਾਈਡ ਅਤੇ ਡਰੋਅਸ ਜਿਸ ਤਰਾਂ ਬੈਡ ਦੀ ਟੋਡੀ ਸਾਈਡ 'ਤੇ ਡਰੋਜ ਹੁੰਦੇ ਨਾ ਜਿੱਥੇ ਆਪਾਂ ਬੈਡ ਸ਼ੀਟਸ ਵਗੈਰਾ ਵੀ ਛੋਟੀ ਮੋਟਾ ਸਮਾਨ ਵੀ ਰੱਖ ਸਕਦੇ ਹਾਂ ਅਤੇ ਥੋੜ੍ਹੀ ਬੈੱਡ ਦੀ ਜਿਹੜੀ ਉਹ ਹੈ ਲੈਂਥ ਹੈ ਉਹ ਥੋੜ੍ਹੀ ਜ਼ਿਆਦਾ ਹੋਵੇ ਕਿਉਂਕਿ ਮੇਰੇ ਬੇਟੇ ਦੀ ਲੈਂਥ ਵੀ ਜ਼ਿਆਦਾ ਹੈ ਤਾਂ ਨੋਰਮਲ ਲੈਂਥ ਨਾਲੋਂ ਔਰ ਦੂਸਰਾ ਬੈੱਡ ਦੀ ਢੋਅ ਜਿਹੜੀ ਹੈ ਉਹ ਥੋੜ੍ਹੀ ਸਰ ਡੈਕੋਰੇਟਿਵ ਜੀ ਹੋਵੇ ਜਿਵੇਂ ਬੱਚਿਆਂ ਨੇ ਭੱਟ ਉਹਦੀ ਸਫਾਈ ਆਰਾਮ ਨਾਲ ਹੋ ਸਕੇ ਇਹ ਨਹੀਂ ਕਿ ਉਹਦੇ ਹਰ ਜਗ੍ਹਾ ਅਤੇ ਚੀਥਾਂ ਦੇ ਵਿੱਚ ਉਹ ਮਿੱਟੀ ਵਗੈਰਾ ਫਸ ਜਾਵੇ ਹਾਂਜੀ ਉਹਦੇ ਲਈ ਤੁਸੀਂ ਮੈਨੂੰ ਥੋੜ੍ਹਾ ਗਾਈਡ ਕਰ ਦੇਣਾ ਬਾਕੀ ਅਗਰ ਤੁਹਾਡੇ ਕੋਲ ਕੋਈ ਕੈਟਾਲੋਗ ਵਗੈਰਾ ਹੈ ਬੈਡ ਤਦੇ ਡਿਜ਼ਾਇਨਸ ਤੁਹਾਡੇ ਕੋਲ ਹੋਣਗੇ ਤਾਂ ਜਿਸ ਤਰਾਂ ਤੁਸੀਂ ਉਹਨਾਂ ਨੂੰ ਇੱਕ ਸਪੈਸ਼ਲ ਚੀਜ਼ ਬਣਾ ਕੇ ਦਿੱਤੀ ਹੈ ਨਾ ਕਿ ਉਹਨਾਂ ਦੀ ਅਲਮੀਰਾ ਦੇ ਵਿੱਚ ਇਸੇ ਤਰੀਕੇ ਨਾਲ ਮੈਨੂੰ ਬੈਡ ਦੇ ਲਈ ਵੀ ਕੋਈ ਚੀਜ਼ ਸਪੈਸ਼ਲ ਕੋਈ ਐਸੀ ਚੀਜ਼ ਜਿਹਦੇ ਨਾਲ ਉਹਦੇ ਵਿੱਚ ਮੈਂ ਇੱਕ ਸਮਾਨ ਕਾਫੀ ਰੱਖ ਸਕਾਂ ਉੱਦਾਂ ਦਾ

ਸਰ ਤੁਸੀਂ ਮੈਨੂੰ ਥੋੜ੍ਹਾ ਮਿਨੀਮਮ ਉਹਦੀ ਕੋਸਟ ਵੀ ਦੱਸ ਸਕਦੇ ਹੋ ਕਿ ਕਿੱਥੋਂ ਤੱਕ ਮਤਲਬ ਇਹ ਪਹੁੰਚ ਸਕਦਾ ਜੇਕਰ ਆਪਾਂ ਸਿੰਪਲ ਮਤਲਬ ਥੋੜ੍ਹਾ ਇਸ ਤਰਾਂ ਬੈੱਡ ਬੋਕਸ ਹੋਮ ਡਰੋਜ ਬਣੇ ਹੋਣ ਅਤੇ ਢੋਅ ਮੈਂ ਸਿੰਪਲ ਹੀ ਰਖਵਾਉਣਾ ਚਾਹੁੰਦੀ ਆ ਅਤੇ ਇੰਨਾ ਕੁ ਥੋੜ੍ਹਾ ਮੈਨੂੰ ਮਿਨੀਮਮ ਚਾਰਜਿਸ ਦੱਸ ਦਿਓ ਪਲੀਜ਼

ਦੇਖੋ ਸਰ ਮੈਨੂੰ ਤਾਂ ਲੱਕੜ ਬਾਰੇ ਇੰਨੀ ਜ਼ਿਆਦਾ ਨੌਲੇਜ ਨਹੀਂ ਹੈ ਉਹ ਤਾਂ ਹੁਣ ਮੈਂ ਤੁਹਾਡੇ 'ਤੇ ਵਿਸ਼ਵਾਸ ਕਰ ਸਕਦੀ ਹੈ ਕਿ ਤੁਸੀਂ ਅੱਛੇ ਤੋਂ ਅੱਛਾ ਪ੍ਰੋਡਕਟ ਸਾਨੂੰ ਪ੍ਰੋਵਾਈਡ ਕਰਨ

ਇਹ ਤੁਸੀਂ ਬੈੱਡ ਮੈਨੂੰ ਕਿੰਨੀ ਦੇਰ ਤੱਕ ਪ੍ਰੋਵਾਈਡ ਕਰ ਸਕਦੇ ਹੋ ਸਰ ਇਹ ਤਾਂ ਬਹੁਤ ਜ਼ਿਆਦਾ ਟਾਈਮ ਹੈ ਹੈਲੋ ਤੁਸੀਂ ਮੈਨੂੰ ਕਦੋਂ ਤੱਕ ਮਿਲ ਸਕਦੇ ਹੋ ਸਰ ਤੁਸੀਂ ਆਪਣਾ ਅੱਛਾ ਠੀਕ ਹੈ ਸਰ ਠੀਕ ਹੈ ਜੀ ਓਕੇ ਥੈਂਕ ਯੂ ਥੈਂਕ ਯੂ